ਮੇਰਾ ਸਭ ਤੋਂ ਪਸੰਦੀਦਾ ਗਜ਼ਲ ਗਾਇਕ ਨੁਸਰਤ ਫਤਿਹ ਅਲੀ ਖਾਨ ਹੈ ਉਸ ਦੀ ਆਵਾਜ਼ ਕਾਰਨ ਮੈਨੂੰ ਉਹ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਉਹ ਆਪਣੀ ਗਜ਼ਲਾਂ ਦੇ ਵਿੱਚ ਦੁਨੀਆਂ ਦਾ ਸੱਚ ਲਿਖਦਾ ਨਜ਼ਰ ਆਉਂਦਾ ਜਿੱਦਾਂ ਉਹਦੀ ਇੱਕ ਗਜ਼ਲ ਸਭ ਤੋਂ ਜ਼ਿਆਦਾ ਜੋ ਮੈਨੂੰ ਬਹੁਤ ਵਧੀਆ ਲੱਗਦੀ ਅਤੇ ਉਹ ਬਹੁਤ ਜ਼ਿਆਦਾ ਮਸ਼ਹੂਰ ਵੀ ਹੈ ਜਿਹਦਾ ਨਾਮ ਹੈ ਉੱਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਇਸ ਗਜ਼ਲ ਦੇ ਵਿੱਚ ਇਹ ਦੱਸਿਆ ਗਿਆ ਕਿ ਜਦੋਂ ਬੰਦਾ ਮਰ ਜਾਂਦਾ ਉਸ ਤੋਂ ਬਾਅਦ ਕੋਈ ਕਿਸੇ ਨੂੰ ਕੁਛ ਨਹੀਂ ਪੁੱਛਦਾ ਕਿ ਕੌਣ ਸੀ ਕਿੱਦਾਂ ਸੀ ਸਭ ਤੋਂ ਪਹਿਲਾਂ ਬਸ ਜਬ ਤੱਕ ਉਹ ਬੰਦਾ ਜੀਅ ਰਿਹਾ ਹੈ ਆਪਣੇ ਆਖਰੀ ਦਮ ਨਹੀਂ ਕਰ ਦਮ ਤੱਕ ਜੀਅ ਰਿਹਾ ਨਾ ਉਦੋਂ ਤੱਕ ਕਿ ਤੁਹਾਨੂੰ ਕੋਈ ਪੁੱਛਦਾ ਅਤੇ ਨਾਲੇ ਇੱਥੇ ਆਪਣੀ ਦੁਨੀਆਂ ਦੇ ਵਿੱਚ ਜੋ ਆਪਣੀ ਜ਼ਿੰਦਗੀ ਹੈ ਸਾਡੇ ਆਲੇ ਦੁਆਲੇ ਦੇ ਲੋਕ ਸਾਡੀ ਜਾਤ ਜਾਂ ਪਾਤ ਕਰਕੇ ਸਾਨੂੰ ਸਾਨੂੰ ਬੁਲਾਉਂਦੇ ਚਲਾਉਂਦੇ ਹਨ ਕਿ ਕਿੱਦਾਂ ਦਾ ਬੰਦਾ ਇਹਦੀ ਜਾਤ ਉੱਚੀ ਹੈ ਨੀਵੀਂ ਹੈ ਫਿਰ ਸਾਨੂੰ ਉਸ ਹਿਸਾਬ ਨਾਲ ਬੁਲਾਉਂਦੇ ਚਲਾਉਂਦੇ ਹਨ ਅਤੇ ਇਹ ਦੱਸ ਰਹੇ ਕਿ ਉੱਥੇ ਅਮਲਾਂ 'ਚ ਕਿ ਬੰਦਾ ਮਰ ਗਿਆ ਨਾ ਅਤੇ ਉੱਥੇ ਜਾ ਕੇ ਕਿਸੇ ਨੇ ਤੁਹਾਡੀ ਜਾਤ ਨਹੀਂ ਪੁੱਛਣੀ ਉੱਥੇ ਸਿਰਫ ਆਪਾਂ ਇੰਨੇ ਦੂਰ ਜਾਣਾ ਕੋਈ ਸਾਨੂੰ ਕੁਛ ਨਹੀਂ ਪੁੱਛੇਗਾ ਕਿ ਤੁਸੀਂ ਕੌਣ ਹੋ ਕਿੱਥੋਂ ਦੀ ਆਏ ਹੋ ਸਾਡਾ ਕਿਉਂਕਿ ਰੱਬ ਦਾ ਸਿਰਫ ਇੱਕ ਹੀ ਬੰਦਾ ਆ ਜਿਹਨੇ ਸਾਨੂੰ ਸਾਡੇ ਥੱਲੇ ਜ਼ਮੀਨ 'ਤੇ ਭੇਜਿਆ ਅਤੇ ਅਸੀਂ ਹੀ ਉਸ ਨੂੰ ਪੂਰੀ ਚੰਗੀ ਤਰ੍ਹਾਂ ਰਹਿਣਾ ਇਹ ਤਾਂ ਸਾਡੇ ਲੋਕਾਂ ਨੇ ਜਾਤਾਂ ਪਾਤਾਂ ਬਣਾਈਆਂ ਹੋਈਆਂ ਅਤੇ ਇਸ ਲਈ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਉਹੀ ਗਜ਼ਲ ਲੱਗਦੀ ਹੈ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ